ਮੈਨੂੰ ਖੇਤੀਬਾੜੀ ਬਹੁਤ ਪਸੰਦ ਹੈ ਅਤੇ ਹੁਣ ਜਿੱਦਾਂ ਸਮੇਂ ਦੇ ਨਾਲ ਨਾਲ ਅਸੀਂ ਉਸੇ ਚੀਜ਼ਾਂ ਦੀ ਖੇਤੀ ਕਰਦੇ ਹਾਂ ਜਿਵੇਂ ਹੁਣ ਸਰਦੀਆਂ ਦੇ ਮੌਸਮ ਵਿੱਚ ਸਾਗ ਅਤੇ ਮੂਲੀ ਦੀ ਖੇਤੀ ਕੀਤੀ ਹੋਈ ਹੈ ਅਸੀਂ ਅਤੇ ਇਹਨਾਂ ਨੂੰ ਜਿਹੜੇ ਕੀਟਨਾਸ਼ਕ ਦਵਾਈ ਹੈ ਉਹਨਾਂ ਦਾ ਪ੍ਰਯੋਗ ਕਰਦੇ ਹਨ ਪਰ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਫਸਲ ਹੈ ਉਹ ਤਾਂ ਚੰਗੀ ਤਰ੍ਹਾਂ ਉੱਗ ਉੱਗ ਜਾਂਦਾ ਹੈ ਪਰ ਜਿਹੜੇ ਸਾਡੀ ਧਰਤੀ ਹੈ ਜ਼ਮੀਨ ਹੈ ਉਹ ਖਰਾਬ ਹੁੰਦੀ ਜਾਂਦੀ ਹੈ ਜਿਸ ਕਰਕੇ ਬਹੁਤ ਨੁਕਸਾਨ ਹੋ ਜਾਂਦਾ ਪਰ ਜਿਹੜੇ ਫਸਲ ਹੈ ਉਹ ਤਾਂ ਠੀਕ ਠਾਕ ਉੱਗ ਜਾਂਦਾ ਪਰ ਜਿਹੜੀ ਜ਼ਮੀਨ ਹੈ ਉਹ ਖਰਾਬ ਹੋ ਰਹੀ ਹੇ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਦੂਸਰੇ ਦੇ ਦੇਸੀ ਖਾਦਾਂ ਦਾ ਪ੍ਰਯੋਗ ਕਰੀਏ ਤਾਂ ਕਿ ਸਾਡਾ ਜਿਹੜਾ ਜ਼ਮੀਨ ਹੈ ਉਹ ਖਰਾਬ ਵੀ ਨਾ ਹੋਵੇ ਅਤੇ ਫਸਲ ਵੀ ਵਧੀਆ ਰਹੇ